ਰੂਪਨਗਰ ਵਿੱਚ ਜੇਕਰ ਪਕਵਾਨ ਜਾਂ ਭੋਜਨ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਲੱਸੀ ਪੰਜੀਰੀ ਕਾਫ਼ੀ ਜ਼ਿਆਦਾ ਬਣਾਏ ਜਾਂਦੇ ਹਨ ਜੇ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਨੂੰ ਬਣਾਉਣ ਲਈ ਪਹਿਲਾਂ ਤਾਂ ਖੇਤਾਂ ਵਿੱਚੋ ਸਰ੍ਹੋਂ ਹੁੰਦੀ ਹੈ ਉਸ ਨੂੰ ਹੀ ਤੋੜ ਕੇ ਫਿਰ ਸਾਗ ਤਿਆਰ ਕੀਤਾ ਜਾਂਦਾ ਹੈ ਉਸ ਵਿੱਚ ਆਲ਼ਣ ਦੇ ਤੌਰ 'ਤੇ ਮੱਕੀ ਦਾ ਆਟਾ ਪਾਇਆ ਜਾਂਦਾ ਹੈ ਫਿਰ ਮੱਕੀ ਦੀ ਰੋਟੀ ਤਾਂ ਫਿਰ ਮੱਕੀ ਦੇ ਆਟੇ ਤੋਂ ਹੀ ਤਿਆਰ ਕੀਤੀ ਜਾਂਦੀ ਹੈ ਲੱਸੀ ਨੂੰ ਬਣਾਉਣ ਲਈ ਦੁੱਧ ਨੂੰ ਪਹਿਲਾਂ ਦਹੀਂ ਲਾਇਆ ਜਾਂਦਾ ਹੈ ਫਿਰ ਉਸ ਤੋਂ ਲੱਸੀ ਤਿਆਰ ਕੀਤੀ ਜਾਂਦੀ ਹੈ ਜੋ ਕਿ ਸਿਹਤ ਲਈ ਵੀ ਕਾਫ਼ੀ ਚੰਗੀ ਹੁੰਦੀ ਹੈ ਜੇ ਪੰਜੀਰੀ ਦੀ ਗੱਲ ਕੀਤੀ ਜਾਵੇ ਪੰਜੀਰੀ ਨੂੰ ਬਣਾਉਣ ਲਈ ਆਟਾ ਦੇਸੀ ਘੀ ਡਰਾਈ ਫਰੂਟ ਅਤੇ ਹੋਰ ਕਈ ਤਰ੍ਹਾਂ ਦੇ ਏ ਕੁਛ ਪਾਇਆ ਜਾ ਸਕਦਾ ਹੈ ਇਹਦੇ ਵਿੱਚ ਜੇ ਜਿੰਨੀ ਅਸੀਂ ਵਧੀਆ ਸਮਾਨ ਇਸ ਵਿੱਚ ਪਾਵਾਂਗੇ ਪੰਜੀਰੀ ਓਨੀ ਹੀ ਵਧੀਆ ਤਿਆਰ ਹੋਜੂਰੀ ਜੋ ਕਿ ਸਰਦੀਆਂ ਲਈ ਸਰੀਰ ਨੂੰ ਖਾਣ ਵਿੱਚ ਕਾਫ਼ੀ ਲਾਹੇਵੰਦ ਹੁੰਦੀ ਹੈ ਜੇਕਰ ਆਪਾਂ ਜਾਣ ਦੀ ਗੱਲ ਕਰੀਏ ਤਾਂ ਸਾਨੂੰ ਰੋਪੜ ਵਿੱਚ ਜੈਨ ਢਾਬਾ ਹੈ ਉੱਥੇ ਜਾ ਸਕਦੇ ਹਾਂ ਉੱਥੇ ਵੀ ਭੋਜਨ ਕਾਫੀ ਚੰਗਾ ਹੁੰਦਾ ਹੈ ਅਤੇ ਉਹਨਾਂ ਦਾ ਰੇਟ ਵੀ ਜਾਇਜ਼ ਹੁੰਦਾ ਹੈ ਅਤੇ ਉਹਨਾਂ ਦਾ ਵਰਤਾਓ ਵੀ ਕਾਫ਼ੀ ਚੰਗਾ ਹੈ ਜਾਂ ਫਿਰ ਆਸ਼ੀਰਵਾਦ ਹੋਟਲ ਹੈ ਉਹਨਾਂ ਦਾ ਵੀ ਕਾਫ਼ੀ ਚੰਗਾ ਵਰਤਾਓ ਹੈ ਅਤੇ ਉਹਨਾਂ ਦੇ ਰੇਟ ਵੀ ਜਾਇਜ਼ ਹਨ ਅਤੇ ਉਹ ਉਹਨਾਂ ਦਾ ਆਓਭਾਗਤ ਵੀ ਬਹੁਤ ਕਰਦੇ ਹਨ